ਆਧੁਨਿਕ ਸੰਸਾਰ ਵਿੱਚ ਲੋਕਾਂ ਲਈ ਮੇਰੇ ਹਿਸਾਬ ਨਾਲ ਤਕਨੀਕੀ ਹੁਨਰ ਵੀਡੀਓ ਕਾਨਫਰੰਸਿੰਗ ਹੈ ਇਹਦਾ ਅਸੀਂ ਘਰ ਬੈਠੇ ਬੈਠੇ ਹੀ ਬਹੁਤ ਜਿਆਦਾ ਲਾਭ ਉਠਾ ਸਕਦੇ ਹਾਂ ਜਿਵੇਂ ਕਿ ਘਰ ਬੈਠੇ ਬੈਠੇ ਅਸੀਂ ਬਾਹਰਲੇ ਮੁਲਕਾਂ ਨੂੰ ਦੇਖ ਸਕਦੇ ਆਂ ਵੀਡੀਓ ਕਾਲਿੰਗ ਕਰਕੇ ਸਾਡਾ ਕੋਈ ਰਿਲੇਟਿਵ ਗਿਆ ਕੋਈ ਭੈਣ ਭਰਾ ਗਿਆ ਤੇ ਉਹ ਸਾਨੂੰ ਬਾਹਰਲਾ ਸਾਰਾ ਦ੍ਰਿਸ਼ ਦੇਖਾ ਦਿਖਾ ਸਕਦਾ ਸਾਨੂੰ ਵੀਡੀਓ ਕਾਲ ਕਰਕੇ ਇਹਦੇ ਨਾਲ ਐ ਆਧੁਨਿਕ ਤਕਨੀਕੀ ਇਕ ਸਬ ਸੇ ਵੱਡਾ ਉਪਹਾਰ ਸਾਨੂੰ ਦਿੱਤਾ ਗਿਆ ਕਿ ਅਸੀਂ ਘਰ ਬੈਠੇ ਬੈਠੇ ਸਾਰੇ ਸੰਸਾਰ ਨੂੰ ਦੇਖ ਸਕਦੇ ਆ ਪਹਿਲੇ ਤਾਂ ਬਹੁਤ ਮੁਸ਼ਕਿਲ ਹੋਇਆ ਕਰਦਾ ਸੀਗਾ ਬਾਹਰਲੇ ਮੁਲਕਾਂ ਤੇ ਜਾਣਾ ਹੁਣ ਅਸੀਂ ਕਾਰ ਬੈਠੇ ਬੈਠੇ ਹੀ ਬਾਹਰਲੇ ਮੁਲਕਾਂ ਨੂੰ ਦੇਖ ਸਕਦੇ ਹਾਂ

ਵੀਡੀਓ ਕਾਲ ਕਰਕੇ ਵੀਡੀਓ ਕਾਲ ਕਰਕੇ ਇੰਨੀ ਸਾਨੂੰ ਤਕਨੀਕੀ ਉਪਹਾਰ ਮਿਲਿਆ ਹੈ ਕੀ ਅਸੀਂ ਘਰ ਬੈਠੇ ਹੀ ਬਾਹਰ ਕੀ ਚੱਲ ਰਿਹਾ ਕਿੱਦਾਂ ਦਾ ਮੌਸਮ ਹੈ ਬਾਹਰਲੇ ਮੁਲਕ ਦੇ ਵਿੱਚ ਕੀ ਕੀ ਵਿਕਰਿਆ ਖਾਣ ਪੀਣ ਦਾ ਕੀ ਹੈ ਪੈਣ ਵਾਸਤੇ ਕੀ ਹੈ ਲੈਣ ਦੇਣ ਵਾਸਤੇ ਕੀ ਹ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਵੀਡੀਓ ਕਾਲ ਕਰਕੇ ਘਰ ਬੈਠੇ ਬੈਠੇ ਸਾਨੂੰ ਇਨੀ ਸਹੂਲਤਾਂ ਪ੍ਰਾਪਤ ਹਨ ਵੀਡੀਓ ਕਾਲ ਇੱਕ ਬਹੁਤ ਵੱਡਾ ਉਪਹਾਰ ਹੈ ਤਕਨੀਕੀ ਆਧੁਨਿਕ ਜਮਾਨੇ ਦੇ ਵਿੱਚ ਮੈਨੂੰ ਲੱਗਦਾ ਹੈ ਕੀ ਵੀਡੀਓ ਕਾਲ ਕਰਕੇ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਆਸਾਨ ਬਣਾ ਦਿੱਤਾ ਗਿਆ ਹੈ ਇਸ ਕਰਕੇ ਵੀਡੀਓ ਕਾਲ ਬੈਸਟ ਆਪਸ਼ਨ